ਸਾਡੇ ਆਲੇ ਦੁਆਲੇ ਜਿਹੜੇ ਕਿਲ੍ਹੇ ਹੈ ਸਾਡੇ ਸਭ ਤੋਂ ਮਸ਼ਹੂਰ ਕਿਲ੍ਹਾ ਹੈ ਕਿਲ੍ਹਾ ਮੁਬਾਰਕ ਬਠਿੰਡਾ ਜੋ ਕਿ ਬਠਿੰਡੇ ਸ਼ਹਿਰ ਦੇ ਵਿੱਚ ਹੈ ਬਠਿੰਡਾ ਸ਼ਹਿਰ ਸਾਡੇ ਤੋਂ ਪੰਜਾਹ ਕਿਲੋਮੀਟਰ ਦੀ ਦੂਰੀ 'ਤੇ ਹੈ ਬਠਿੰਡੇ ਦਾ ਜਿਹੜਾ ਕਿਲ੍ਹਾ ਸ ਕਿਲ੍ਹਾ ਸਾਹਿਬ ਆ ਉਹਨੂੰ ਕਿਲ੍ਹਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਪ੍ਰਕਾਸ਼ਿਤ ਹੈ ਜਿਹਦੇ ਕਰਕੇ ਸਾਡੇ ਬਠਿੰਡੇ ਨੂੰ ਕਿਲ੍ਹਾ ਮੁਬਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਕਿਲ੍ਹੇ ਦੇ ਕਰਕੇ ਹੀ ਬਠਿੰਡੇ ਦੀ ਜੋ ਹੈ ਪਹਿਚਾਣ ਇੱਕ ਅਲੱਗ ਵੱਖਰੇ ਤੌਰ 'ਤੇ ਹੋਈ ਵੀ ਹੈ ਕਿਲ੍ਹਾ ਬਠਿੰਡੇ ਦਾ ਸਭ ਤੋਂ ਸੁੰਦਰ ਅਤੇ ਸਭ ਤੋਂ ਬਹੁਤ ਅਲੌਕਿਕ ਦ੍ਰਿਸ਼ ਪ੍ਰਦਾਨ ਕਰਦਾ ਹੈ ਜਿਹਦੇ ਕਰਕੇ ਇਹ ਸਾਡੇ ਬਠਿੰਡੇ ਜ਼ਿਲ੍ਹੇ ਦੇ ਆਲੇ ਦੁਆਲੇ ਦੇ ਪਿੰਡਾਂ ਅਤੇ ਹੋਰ ਸ਼ਹਿਰਾਂ ਦੇ ਲਈ ਇੱਕ ਵੱਖਰੀ ਦਿੱਖ ਰੱਖਦਾ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਮਹਿਲਾਂ ਦੇ ਨਾਮ ਕਈ ਸਾਡੇ ਇੱਥੇ ਪਰ ਉਹਨਾਂ ਦੀ ਦੂਰੀ ਸਾਡੇ ਤੋਂ ਕਾਫੀ ਜ਼ਿਆਦਾ ਹੈ ਮੇਨਲੀ ਤਾਂ ਸਾਡੇ ਜਿਹੜਾ ਬਠਿੰਡਾ ਕਿਲ੍ਹਾ ਹੀ ਮਸ਼ਹੂਰ ਹੈ